ਹੈਲੋ ਹਾਂਜੀ ਦੀਦੀ ਅੱਛਾ ਤੁਸੀਂ ਨਵੇਂ ਆਏ ਹੋ ਕੰਮ 'ਤੇ ਅਤੇ ਮੈਂ ਤੁਹਾਡੀਆਂ ਡਿਊ ਡਿਊਟੀਜ਼ ਅ ਕੁਝ ਦੱਸ ਦਾਂ ਜੀ ਜਿਹੜੇ ਜਿਹੜੇ ਕੰਮ ਤੁਹਾਨੂੰ ਰੋਜ਼ ਉਨ ਆ ਕੇ ਕਰਨੇ ਹੀ ਪੈਣੇ ਹੈ ਤੁਹਾਨੂੰ ਭਾਵੇਂ ਕੋਈ ਆ ਕੇ ਕਹੇ ਨਾ ਕਹੇ ਤੁਸੀਂ ਉਹ ਕੰਮ ਕਰਨੇ ਹੀ ਕਰਨੇ ਹੈ ਠੀਕ ਹੈ ਅਤੇ ਸਾਰਿਆਂ ਤੋਂ ਪਹਿਲੇ ਤਾਂ ਤੁਸੀਂ ਸਕੂਲ ਦੇ ਵਿੱਚ ਆਉਂਦੇ ਹੀ ਸਾਰੀਆਂ ਕਲਾਸਾਂ ਖੋਲ੍ਹਣੀਆਂ ਹੈ ਜੀ ਅਤੇ ਉਹ ਕਲਾਸਾਂ ਨੂੰ ਫਿਰ ਚੈੱਕ ਕਰਨਾ ਇੱਕ ਇੱਕ ਕਰਕੇ ਕਿ ਸਾਰੀਆਂ ਚੀਜ਼ਾਂ ਠੀਕ ਹੋਣ ਬੈਂਚ ਬੁੰਚ ਸਹੀ ਹੈ ਨਹੀਂ ਹੈ ਅਤੇ ਜਿਹੜੇ ਆਪਣੇ ਟੇਬਲ ਚੇਅਰ ਹੁੰਦੇ ਹੈ ਟੀਚਰਸ ਦੇ ਤੁਸੀਂ ਉਹਨਾਂ ਨੂੰ ਸਾਫ਼ ਸਾਫ਼ ਰੱਖਣਾ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਸਾਫ਼ ਕਰ ਦੇਣਾ ਤੁਸੀਂ ਸਾਰਾ ਠੀਕ ਹੈ ਅਤੇ ਫਿਰ ਆਪਣੇ ਅ ਸ਼ਾਮ ਨੂੰ ਉਹ ਜਿਵੇਂ ਸਫਾਈ ਕਰਕੇ ਜਾਂਦੇ ਆ ਸਕੂਲ ਦੇ ਵਿੱਚ ਅਤੇ ਤੁਸੀਂ ਉਹ ਸਫਾਈ ਦਾ ਵੀ ਧਿਆਨ ਰੱਖਣਾ ਕਿ ਉਹ ਵੀ ਠੀਕ ਕਰਦਾ ਨਹੀਂ ਕਰਦਾ ਵਧੀਆ ਕਰਦਾ ਕਿ ਨਹੀਂ ਕਰਦਾ ਤੁਸੀਂ ਇਹਦੀ ਰਿਪੋਰਟ ਦਿੰਦੇ ਰਹਿਣਾ ਸਾਨੂੰ ਜੇ ਉਹ ਕੰਮ ਠੀਕ ਨਹੀਂ ਕਰਦਾ ਤਾਂ ਤੁਸੀਂ ਦੱਸਣਾ ਹੈ ਸਾਨੂੰ ਠੀਕ ਹੈ ਜੀ ਇੰਨਾ ਜੇ ਕੰਮ ਸਮਝ ਆ ਗਿਆ ਉਸ ਤੋਂ ਬਾਅਦ ਜੀ ਤੁਸੀਂ ਆਪਣੇ ਟਾਈਮ ਟੂ ਟਾਈਮ ਨਾ ਸਾਰੇ ਟੀਚਰਾਂ ਨੂੰ ਜੀ ਪਾਣੀ ਦੇਣਾ ਹੁੰਦਾ ਆਪਣੇ ਸਕੂਲ ਦੇ ਵਿੱਚ ਠੀਕ ਹੈ ਦੋ ਤਿੰਨ ਟਾਈਮ 'ਤੇ ਤੁਸੀਂ ਟੀਚਰਾਂ ਨੂੰ ਪਾਣੀ ਦੇ ਹੀ ਦੇਣਾ ਉਸ ਤੋਂ ਇਲਾਵਾ ਉਹ ਆਪ ਕਦੇ ਮੰਗ ਲੈਣ ਤਾਂ ਗੱਲ ਵੱਖਰੀ ਹੈ ਅਤੇ ਵੈਸੇ ਦੋ ਤਿੰਨ ਟਾਈਮ 'ਤੇ ਦੇਣਾ ਹੀ ਦੇਣਾ ਉਹਨਾਂ ਨੂੰ ਪੱਕੇ ਤੌਰ 'ਤੇ ਅਤੇ ਬਾਕੀ ਆਪਣੇ ਤੁਸੀਂ ਬੱਚਿਆਂ ਦਾ ਧਿਆਨ ਰੱਖਣਾ ਕਿ ਬੱਚੇ ਜਿਵੇਂ ਕੋਈ ਬਾਹਰ ਨਾ ਚਲੇ ਜਾਣ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜਾ ਬੱਚਾ ਕਿੱਥੇ ਚੱਲਿਆ ਕੱਲ੍ਹ ਨੂੰ ਉਹ ਹੀ ਗੱਲ ਹੈ ਹੈ ਨਾ ਕੋਈ ਪੇਰੈਂਟਸ ਦੀ ਆਪਾਂ ਆਪਾਂ ਨੂੰ ਸ਼ਿਕਾਇਤ ਨਾ ਆ ਜਾਏ ਕਿ ਉਹਨਾਂ ਦਾ ਬੱਚਾ ਕਿੱਥੇ ਅਤੇ ਆਪਾਂ ਨੂੰ ਪਤਾ ਹੀ ਉਹ ਨਾ ਹੋਵੇ ਉਹਨਾਂ ਦਾ ਅਤੇ ਨਾਲ ਨਾਲ ਬਸ ਕੁਝ ਨਹੀਂ ਹੋਰ ਛੋਟੇ ਮੋਟੇ ਜਿਵੇਂ ਕੰਮ ਹੁੰਦੇ ਆ ਟੀਚਰ ਤੁਹਾਨੂੰ ਜਿਹੜੇ ਵੀ ਕੰਮ ਕਹਿਣ ਤੁਸੀਂ ਨਾਂਹ ਨਹੀਂ ਕਰਨੀ ਕਿਸੇ ਕੰਮ ਨੂੰ ਅਤੇ ਉਹਨਾਂ ਦੀਆਂ ਗੱਲਾਂ ਮੰਨਣੀਆਂ ਅਤੇ ਨਾਲ ਨਾਲ ਆਹ ਜਦੋਂ ਹੁਣ ਆਪਣੇ ਪੇਪਰ ਹੋਣੇ ਹੈ ਉਦੋਂ ਸਿਟਿੰਗ ਪਲਾਨ ਦੇ ਵਿੱਚ ਜਿਵੇਂ ਬੱਚਿਆਂ ਨੂੰ ਬਿਠਾਉਣਾ ਹੁੰਦਾ ਹੈ ਆਪਾਂ ਅਤੇ ਤੁਸੀਂ ਉਹ ਬਿਠਾਉਣ ਦੇ ਵਿੱਚ ਤੁਸੀਂ ਟੀਚਰਾਂ ਦੀ ਹੈਲਪ ਕਰਨੀ ਹੈ ਉੱਥੇ ਜਿਵੇਂ ਤੁਹਾਨੂੰ ਲਿਸਟ ਮਿਲੇ ਜਿਵੇਂ ਤੁਹਾਨੂੰ ਕਿਹਾ ਜਾਵੇ ਕਿ ਹਾਂ ਬਈ ਇਸ ਕਲਾਸ ਨੂੰ ਲਿਆਓ ਇਸ ਕਲਾਸ ਨੂੰ ਬੁਲਾਓ ਇਹਨੂੰ ਇੱਥੇ ਬਿਠਾਓ ਤਾਂ ਤੁਸੀਂ ਉਹ ਧਿਆਨ ਨਾਲ ਸੁਣ ਕੇ ਤੁਸੀਂ ਉਹੀ ਕਮਾਂਡ ਫੋਲੋ ਕਰਨੀ ਹੈ ਕੋਈ ਕੋਈ ਸ਼ਿਕਾਇਤ ਨਹੀਂ ਦਵਾਉਣੀ ਕਿਸੇ ਪਾਸਿਓਂ ਤੁਹਾਨੂੰ ਨਹੀਂ ਕੋਈ ਗੱਲ ਸਮਝ ਆਉਂਦੀ ਤੁਸੀਂ ਦੁਬਾਰਾ ਪੁੱਛ ਲੈਣਾ ਜੇ ਠੀਕ ਹੈ ਜੀ ਅਤੇ ਕੋਈ ਹੋਰ ਕੋਈ ਗੱਲ ਤੁਹਾਨੂੰ ਪੁੱਛਣੀ ਹੋਵੇ ਤਾਂ ਤੁਸੀਂ ਉਹ ਵੀ ਪੁੱਛ ਸਕਦੇ ਹੋ

ਅਤੇ ਬਾਕੀ ਹੋਰ ਛੋਟੀਆਂ ਵੱਡੀਆਂ ਸਕੂਲ ਦੇ ਵਿੱਚ ਬੜੀਆਂ ਗੱਲਾਂ ਹੁੰਦੀਆਂ ਤੁਸੀਂ ਉਹਨਾਂ ਦਾ ਵੀ ਧਿਆਨ ਰੱਖਣਾ ਆਪਾਂ ਸਾਰੀਆਂ ਹੁਣ ਇੱਥੇ ਕਰ ਨਹੀਂ ਸਕਦੇ ਹੈ ਨਾ ਕੋਈ ਗੱਲ ਯਾਦ ਰਹਿੰਦੀ ਆਪਾਂ ਨੂੰ ਕੋਈ ਨਹੀਂ ਰਹਿੰਦੀ ਬਟ ਇਹ ਹੈ ਕਿ ਕਿਸੇ ਪੱਖੋਂ ਵੀ ਬਸ ਸ਼ਿਕਾਇਤ ਨਾ ਆਵੇ ਆਪਾਂ ਨੂੰ ਠੀਕ ਹੈ ਤੁਹਾਨੂੰ ਇਹ ਸਹੀ ਲੱਗਦੀ ਹੈ ਜੋਬ ਤਾਂ ਤੁਸੀਂ ਫਿਰ ਵੇਖ ਲਿਓ ਅੱਗੇ ਕੰਟੀਨਿਊ ਕਰਨ ਦਾ ਜੇਕਰ ਨਹੀਂ ਲੱਗਦੀ ਤਾਂ ਫਿਰ ਕੋਈ ਗੱਲ ਨਹੀਂ ਤੁਸੀਂ ਦੱਸ ਦਿਓ ਫਿਰ ਆਪਾਂ ਕੁਝ ਹੋਰ ਵੇਖ ਲਾਂਗੇ ਵਧੀਆ ਹਾਂਜੀ ਹਾਂਜੀ ਤੁਸੀਂ ਇਹ ਕੰਮ ਕਰ ਲਉਂਗੇ ਨਾ ਜੀ ਸਾਰੇ ਹਾਂਜੀ ਠੀਕ ਹੈ ਚਲੋ ਫਿਰ ਠੀਕ ਹੈ